ਹੈਲੋ ਹੈਲੋ ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਸਰ ਫੋਟੋਕਾਪੀ ਕਰਨੇ ਆ ਹਾਂਜੀ ਸਰ ਹੋ ਜਾਣਗੇ ਤੁਸੀਂ ਕਿੰਨੇ ਕੁ ਹੈ ਸਰ ਹਾਂਜੀ ਹਾਂ ਸਰ ਹੋ ਜਾਣਗੇ ਸਰ ਅਸੀਂ ਤੁਹਾਡੇ ਕੋਲੋਂ ਤੁਹਾਨੂੰ ਲੈਸ ਵੀ ਦਿਆਂਗੇ ਤੁਹਾਡੇ ਤੋਂ ਘੱਟ ਤੋਂ ਘੱਟ ਰੇਟ ਆ ਲਵਾਂਗੇ ਸੈਵਨ ਅਸੀਂ ਪੰਝੱਤਰ ਪੈਸੇ ਕਾਪੀ ਲਾਵਾਂਗੇ ਉਹਦੇ ਜੀ ਅੱਛਾ ਅੱਛਾ ਚੱਲੋ ਸਰ ਸੱਠ ਪੈਸੇ ਲਾ ਲਵਾਂਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਵਾਇੰਡ ਕਰਕੇ ਦਿਆਂਗੇ ਸਰ ਹਾਂਜੀ ਵਿੱਚੇ ਕਰਦਾਂਗੇ ਕੋਈ ਗੱਲ ਨਹੀਂ ਉਹ ਟਰਾਂਸਪਰੈਂਟ ਲਾ ਦਾਂਗੇ ਨਹੀਂ ਸਰ ਉਹ ਅੱਜ ਕੱਲ੍ਹ ਨਾ ਨਵਾਂ ਸਾਡੇ ਕੋਲ ਨਵੀਂ ਤਕਨੀਕ ਆ ਇੱਕ ਸਟੈਪਲਰ ਆਇਆ ਹੋਇਆ ਵੱਡੇ ਸਾਇਜ਼ ਦਾ ਸਰ ਉਹਦੇ ਨਾਲ ਪਿੰਨ ਲੱਗਦੀ ਹੈ ਅਤੇ ਉਹ ਉਹ ਤਿੰਨ ਪਿੰਨਾਂਂ ਲਾ ਕੇ ਤੁਹਾਨੂੰ ਨਜ਼ਰ ਹੀ ਨਹੀਂ ਆਉਣੀ ਉਹ ਧਾਗਾ ਵੀ ਨਹੀਂ ਆਉਣਾ ਅਤੇ ਪਿੰਨ ਵੀ ਨਹੀਂ ਆਉਣੀ ਨਹੀਂ ਉਹ ਨਹੀਂ ਸਰ ਉੱਖੜ ਦੀ ਉਹ ਬੜੀ ਓ ਓਹ ਉਹ ਘੱਟੋ ਘੱਟ ਨਾ ਇਹ ਇੱਕ ਫੁੱਟ ਦਾ ਸਟੈਪਲਰ ਹੈ ਬਾਰਾਂ ਇੰਚ ਦਾ ਉਹ ਅਤੇ ਬੜੀ ਜ਼ਬਰਦਸਤ ਪਕੜ ਕਰਦਾ ਹਾਂਜੀ ਸਰ ਹਾਂਜੀ ਸਰ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਕਰਵਾਉਣੀ ਤੁਸੀਂ ਬੈਕ ਸਾਈਡ ਵੀ ਕਰਵਾਉਣੀ ਹੈ ਜਾਂ ਅਲ ਦੂਜੇ ਪਾਸੇ ਕਰਵਾਉਣੀ ਹੈ ਜਿੱਦਾਂ ਸਾਡੇ ਕੋਲ ਹਾਂਜੀ ਹਾਂਜੀ ਹ ਹਾਂ ਇਹ ਤਾਂ ਹੈ ਸਰ ਹਾਂ ਇਹ ਤਾਂ ਹੈ ਇਹ ਤੁਸੀਂ ਇਹ ਹੁਣ ਤੁਸੀਂ ਦੱਸਣਾ ਨਾ ਕਿਉਂਕਿ ਸਾਡੇ ਕੋਲ ਸਾਰੇ ਤਰ੍ਹਾਂ ਦੇ ਆਉਂਦੇ ਆ ਨਾ ਕਸਟਮਰ ਜਿੱਦਾਂ ਕੋਈ ਐਮਫਿਲ ਦਾ ਥੀਸਸ ਕਰਵਾਉਂਦਾ ਜਾਂ ਕੋਈ ਐਮ ਏ ਦਾ ਕਰਵਾਉਂਦੇ ਆ ਕਾਗਜ ਹੈ ਨਾ ਅਤੇ ਉਹ ਉਹ ਕਹਿੰਦੇ ਆ ਵੀ ਕਈ ਵਾਰ ਇੱਕ ਸਾਈਡ ਦੇ ਕਰੋ ਕਈ ਵਾਰ ਦੋ ਉਹ ਉਹ ਜ਼ਿਆਦਾਤਰ ਇੱਕ ਸਾਈਡ ਦੇ ਕਰਵਾਉਂਦੇ ਹੈ ਹਾਂਜੀ ਠੀਕ ਹੈ ਸਰ ਠੀਕ ਹੈ ਓਕੇ ਜੀ ਠੀਕ ਥੈਂਕ ਯੂ ਸਰ